ਸਰ ਆਪਾਂ ਆਪਣੇ ਸਥਾਨ 'ਤੇ ਪਹੁੰਚ ਗਏ ਹਾਂ ਤੁਸੀਂ ਕਿਹਾ ਸੀਗਾ ਵੀ ਸਾਢੇ ਤਿੰਨ ਸੌ ਰੁਪਇਆ ਕਰਾਇਆ ਹੈ ਉਸ ਲਈ ਮੈਂ ਤੁਹਾਨੂੰ ਪੁੱਛਣਾ ਸੀਗਾ ਵੀ ਤੁਹਾਡੇ ਕੋਲ ਯੂਪੀਆਈ ਆਈਡੀ ਹੈ ਜਾਂ ਗੂਗਲ ਪੇ ਰਾਹੀਂ ਪੈਮੈਂਟ ਕਰਨੀ ਜਾਂ ਪੇਟੀਐਮ ਦੁਆਰਾ ਪੇ ਆਪਾਂ ਨੇ ਪੇਮੈਂਟ ਕਰਨੀ ਆ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕੈਸ਼ ਨਹੀਂ ਹੈਗਾ ਮੇਰੇ ਕੋਲ ਅਤੇ ਇਸ ਲਈ ਮੈਂ ਥੋ ਔਨਲਾਈਨ ਪੇਮੈਂਟ ਕਰਾਂਗੀ ਕੀ ਮੈਂ ਉਹ ਔਨਲਾਈਨ ਪੇਮੈਂਟ ਕਰ ਸਕਦੀ ਹਾਂ ਅਗਰ ਤੁਹਾਡੇ ਕੋਲ ਸਕੈਨਰ ਹੈ ਤਾਂ ਮੈਨੂੰ ਸਕੈਨਰ ਸੈਂਡ ਕਰ ਦਿਉ ਜਾਂ ਮੈਨੂੰ ਆਪਣਾ ਨੰਬਰ ਦੇ ਦਿਉ ਆਈਡੀ ਦੇ ਦਿਉ ਕੋਈ ਜਿਹਦੇ 'ਤੇ ਮੈਂ ਔਨਲਾਈਨ ਪੇਮੈਂਟ ਕਰ ਸਕਾਂ ਕਿਉਂਕਿ ਮੇਰੇ ਕੋਲ ਕੈਸ਼ ਨਹੀਂ ਹੈਗਾ ਮੈਂ ਰਸਤੇ ਦੇ ਵਿੱਚ ਏਟੀਐਮ ਵਗੈਰਾ ਵੀ ਆਪਾਂ ਨੇ ਚੈੱਕ ਕੀਤਾ ਸੀ ਉਹ ਏਟੀਐਮ ਖੁੱਲ੍ਹੇ ਨਹੀਂ ਸੀ ਜਿਸ ਕਰਕੇ ਮੈਂ ਪੈਸੇ ਨਹੀਂ ਕਢਵਾ ਸਕੀ ਇਸ ਲਈ ਮੈ ਤੁਹਾਨੂੰ ਕਹਿ ਰਹੀ ਸੀ ਵੀ ਤੁਸੀਂ ਆਪਣਾ ਏਟੀਐਮ ਜਾਂ ਪੇਟੀਐਮ ਜਾਂ ਯੂਪੀਆਈ ਆਈਡੀ ਦੱਸ ਦਿਉ ਉਹਦੇ 'ਤੇ ਮੈਂ ਤੁਹਾਡੀ ਪੇਮੈਂਟ ਕਰ ਸਕਾਂ ਇਹਦੇ ਵਿੱਚ ਕੀ ਹੁੰਦਾ ਮੈਂ ਕੈਸ਼ ਜ਼ਿਆਦਾ ਤਾਂ ਨਹੀਂ ਰੱਖਦੀ ਆਪਣੇ ਕੋਲ ਕਿਉਂਕਿ ਉਹ ਕੈਸ਼ ਡਿੱਗਣ ਦਾ ਡਰ ਰਹਿੰਦਾ ਆ ਜਾਂ ਫਿਰ ਕੁਝ ਵੀ ਹੋ ਜਾਂਦਾ ਰਸਤੇ ਦੇ ਵਿੱਚ ਇਸ ਲਈ ਮੈਂ ਸਾਰੀਆਂ ਪੇ ਜਿਹੜੀਆਂ ਆਪਣੀਆਂ ਟਰਾਜੈਕਸ਼ਨਸ ਹੁੰਦੀਆਂ ਨੇ ਉਹ ਔਨਲਾਈਨ ਹੀ ਕਰ ਦਿੰਦੀ ਹਾਂ ਅਗਰ ਲੋੜ ਪੈਂਦੀ ਥੋੜ੍ਹਾ ਬਹੁਤ ਕੈਸ਼ ਰੱਖ ਲਈ ਦਾ ਪਰ ਹੁਣ ਇੰਨੀ ਮੋਰਨਿੰਗ ਟਾਈਮ ਆਪਾਂ ਨੂੰ ਕਿਤੇ ਰਸਤੇ ਦੇ ਵਿੱਚ ਏਟੀਐਮ ਖੁੱਲ੍ਹਾ ਨਹੀਂ ਮਿਲਿਆ ਨਹੀਂ ਤਾਂ ਮੈਂ ਉੱਥੇ ਤੋਂ ਕਢਵਾ ਕੇ ਤੁਹਾਨੂੰ ਦੇ ਦੇਣੇ ਸੀਗੇ ਔਨਲਾਈਨ ਦੀ ਬਜਾਏ ਕੈਸ਼ ਪੇਮੈਂਟ ਹੀ ਕਰ ਦੇਣੀ ਸੀ